ਕਲਾਸਿਕਲ ਫਿਲਮਾਂ ਭਾਵ ਪੁਰਾਣੀਆਂ ਫਿਲਮਾਂ ਜਿਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਹ ਫਿਲਮਾਂ ਬਿਨਾਂ ਸ਼ੋਰ ਸ਼ਰਾਬੇ ਤੋਂ ਹੁੰਦੀਆਂ ਹਨ ਮੇਰੀਆਂ ਵੀ ਕੁਝ ਮਨ ਪਸੰਦ ਕਲਾਸਿਕਲ ਫਿਲਮਾਂ ਹਨ ਇਹ ਫਿਲਮਾਂ ਸ਼ਾਂਤੀ ਪੂਰਨ ਸੁਭਾਅ ਤੇ ਸਾਡੀ ਬਿਰਤੀ ਨੂੰ ਦਰਸਾਉਂਦੀਆਂ ਹਨ ਮੈਨੂੰ ਕਲਾਸਿਕਲ ਫਿਲਮਾਂ ਬਹੁਤ ਹੀ ਪਸੰਦ ਹਨ ਕੁੱਝ ਮੇਰੀਆਂ ਮਨ ਪਸੰਦ ਫਿਲਮਾਂ ਹਨ ਜੋ ਕਿ ਮੈਨੂੰ ਬਹੁਤ ਪਸੰਦ ਪਰ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਮੈਂ ਉਹਨਾਂ ਦੇ ਵਿੱਚੋਂ ਕਿਹੜੀ ਇੱਕ ਫਿਲਮ ਦੇਖਾਂ ਕਲਾਸੀਕਲ ਫਿਲਮਾਂ ਸਾਨੂੰ ਸੰਦੇਸ਼ ਦਿੰਦੀਆਂ ਹਨ ਸਾਨੂੰ ਚੰਗੇ ਮਾੜੇ ਦੀ ਪਰਖ ਕਰਵਾਉਂਦੀਆਂ ਹਨ ਕਲਾਸਿਕਲ ਫਿਲਮਾਂ ਪਰਿਵਾਰਿਕ ਫਿਲਮਾਂ ਹੁੰਦੀਆਂ ਹਨ ਜਿਨਾਂ ਨੂੰ ਅਸੀਂ ਪੂਰੇ ਪਰਿਵਾਰ ਵਿੱਚ ਬੈਠ ਕੇ ਦੇਖ ਸਕਦੇ ਹਾਂ

ਕਲਾਸੀਕਲ ਫਿਲਮਾਂ ਇੱਕ ਤਰ੍ਹਾਂ ਨਾਲ ਸਾਨੂੰ ਇੱਕ ਸੰਦੇਸ਼ ਦੇਣਾ ਸਾਨੂੰ ਇੱਕ ਤਰ੍ਹਾਂ ਦੀ ਪ੍ਰੇਰਨਾ ਦੇਣੀ ਇਸ ਤਰ੍ਹਾਂ ਦੇ ਕੰਮ ਕਰਦੀਆਂ ਹਨ ਕਲਾਸੀਕਲ ਫਿਲਮਾਂ ਸਾਡੀ ਸੋਚ ਸਾਡੀ ਬਿਰਤੀ ਇਹਨਾਂ ਨੂੰ ਦਰਸਾਉਂਦੀਆਂ ਹਨ ਮੈਨੂੰ ਤੁਹਾਡੀ ਰਾਏ ਦੀ ਜਰੂਰਤ ਹੈ ਕਿ ਮੈਂ ਕਿਸ ਫਿਲਮ ਤੋਂ ਸ਼ੁਰੂ ਕਰਾਂ ਮੈਂ ਆਪਣੀ ਮਨ ਪਸੰਦ ਫਿਲਮ ਦੇਖਣੀ ਹੈ ਤੁਸੀਂ ਮੈਨੂੰ ਸੁਝਾ ਦੋ ਕਿ ਮੈਂ ਇਹਨਾਂ ਫਿਲਮਾਂ ਦੇ ਵਿੱਚੋਂ ਕਿਹੜੀ ਫਿਲਮ ਪਹਿਲਾਂ ਦੇਖਾਂ ਇਹ ਕੁਝ ਕਲਾਸਿਕਲ ਫਿਲਮਾਂ ਹਨ ਜੋ ਕਿ ਮੇਰੀ ਪਸੰਦ ਦੀਆਂ ਹਨ ਮਦਰ ਇੰਡੀਆ ਮੁਗਲ ਏ ਆਜਮ ਜੈਵਲਤੀਫ ਗਾਈਡ ਦੀਵਾਰ ਅਰਾਧਨਾ ਸ਼ੋਲੇ ਪਾਕੀਜਾ ਇਹ ਫਿਲਮਾਂ ਮੇਰੀ ਮਨ ਪਸੰਦੀ ਦਾ ਹਨ ਇਹਨਾਂ ਦਾ ਵੀ ਇੱਕ ਕਾਰਨ ਹੈ ਕਿ ਇਹ ਮੇਰੀਆ ਮਨਪਸੰਦੀਆਂ ਕਿਉਂ ਹਨ ਇਸ ਦਾ ਕਾਰਨ ਇਹ ਹੈ ਕਿ ਇਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਹ ਸਾਨੂੰ ਸੰਦੇਸ਼ ਦਿੰਦੀਆਂ ਹਨ ਤੇ ਸਾਡੇ ਦਿਲ ਨੂੰ ਛੂਹ ਲੈਣ ਵਾਲੀਆਂ ਹਨ